ਬੱਚਿਆਂ ਲਈ ਪੇਂਟਿੰਗ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਹ ਆਪਣਾ ਹੀ ਕੋਈ ਯਾ ਵਿਚਾਰ ਹੁੰਦਾ ਕਿ ਬੱਚੇ ਨੇ ਕਿਸ ਲਾਈ ਵੱਲ੍ਹ ਜਾਣਾ ਪਰ ਇਸਦੀ ਸਟਾਰਟਿੰਗ ਖਾਸ ਤੌਰ 'ਤੇ ਪੰਦਰ੍ਹਾਂ ਸਾਲ ਤੋਂ ਹੀ ਸ਼ੁਰੂ ਹੁੰਦੀ ਹੈ